ਪੰਜਾਬੀ ਭਾਸ਼ਾ ਵਿੱਚ ਰੇਡੀਓ ਟੈਲੀਵਿਜ਼ਨ ਪ੍ਰਿੰਟਾਂ ਵਿੱਚ ਇਸ ਦੀ ਵਰਤੋਂ ਵਧੀਆ ਕੀਤੀ ਜਾ ਸਕਦੀ ਹੈ ਸਾਡੇ ਪੰਜਾਬ ਦੇ ਲੋਕ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਪਰ ਬਾਹਰੋਂ ਬਾਹਰਲੇ ਲੋਕ ਹਨ ਜੋ ਉਹ ਸਾਡੀ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਪਸੰਦ ਕਰਦੇ ਹਨ ਉਹ ਸਾਡੀ ਨਾਲ ਜਦੋਂ ਸਾਡੇ ਪੰਜਾਬ ਵਿੱਚ ਆਉਂਦੇ ਹਨ ਉਹ ਸਾਡੀ ਨਾਲ ਆਪਣੀ ਭਾਸ਼ਾ ਭੁੱਲ ਕੇ ਸਾਡੀ ਪੰਜਾਬੀ ਵਿੱਚ ਸਾਡੇ ਨਾਲ ਗੱਲ ਕਰਦੇ ਹਨ ਪੰਜਾ ਸਾਡੇ ਪੰਜਾਬ ਦੇ ਲੋਕ ਸਾਡੀ ਪੰਜਾਬੀ ਭਾਸ਼ਾ ਭੁੱਲਦੇ ਜਾ ਰਹੇ ਹਨ ਸਾਡੇ ਪੰਜਾਬ ਦੇ ਲੋਕ ਜਦੋਂ ਕੋਈ ਸਾਡੇ ਬਾਹਰੋਂ ਵਿਅਕਤੀ ਆਉਂਦਾ ਹੈ ਤਾਂ ਉਹਨਾਂ ਨਾਲ ਉਹਨਾਂ ਦੀ ਆਪਣੀ ਭਾਸ਼ਾ ਭੁੱਲ ਕੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਨ ਲੱਗ ਜਾਂਦੇ ਹਨ ਟੈਲੀਵਿਜ਼ਨ 'ਤੇ ਪੰਜਾਬੀ ਭਾਸ਼ਾ ਵਿੱਚ ਜਿਵੇਂ ਪੰਜਾਬੀ ਚੈਨਲ ਬਣਾਏ ਗਏ ਹਨ ਜਿਵੇਂ ਗੁਰਬਾਣੀ ਦਾ ਪੰਜਾਬੀ ਵਿੱਚ ਚੈਨਲ ਬਣਾਇਆ ਗਿਆ ਹੈ ਰੇਡੀਓ 'ਤੇ ਪੰਜਾਬੀ ਚੈਨਲ ਆਉਂਦੇ ਹਨ ਪੰਜਾਬੀ ਰੇਡੀਓ 'ਤੇ ਵੀ ਪੰਜਾਬੀ ਭਾਸ਼ਾ ਵਰਤੀ ਜਾਂਦੀ ਹੈ